ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਕਿਉਂਕਿ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕਰ ਕਰਨ ਵਿੱਚ ਭੰਗੜਾ ਸਭ ਤੋਂ ਵਧੀਆ ਸਾਧਨ ਹੈ ਜਿੱਥੇ ਵੀ ਜਾਂਦੇ ਹਾਂ ਜੇ ਪੰਜਾਬੀ ਭੰਗੜਾ ਪਾਉਂਦੇ ਨਜ਼ਰ ਆ ਜਾਂਦੇ ਤਾਂ ਸਭ ਕਹਿ ਦਿੰਦੇ ਵੀ ਇਹ ਪੰਜਾਬ ਹੈ ਪੰਜਾਬ ਦੇ ਲੋਕ ਹਨ ਕਿਉਂਕਿ ਇਸ ਤੋਂ ਬਿਨਾਂ ਕੋਈ ਪੰਜਾਬ ਦਾ ਤਿਉਹਾਰ ਕੋਈ ਵੀ ਵਿਆਹ ਕੋਈ ਵੀ ਬੱਚਾ ਜਨਮ ਕੋਈ ਵੀ ਤਿਉਹਾਰ ਆਉਂਦਾ ਹੈ ਤਾਂ ਉਹਦੇ ਵਿੱਚ ਭੰਗੜੇ ਪਾਏ ਜਾਂਦੇ ਹਨ ਕਿਉਂਕਿ ਭੰਗੜਾ ਹੀ ਹੈ ਜੋ ਪੰਜਾਬੀਆਂ ਦੀ ਆਨ ਬਾਨ ਅਤੇ ਸ਼ਾਨ ਹੈ ਅਤੇ ਪੰਜਾਬੀਆਂ ਦੀ ਪਹਿਚਾਣ ਹੈ ਪੰਜਾਬ ਅਤੇ ਸੱਭਿਆ ਵੀ ਸੱਭਿਆਚਾਰ ਵਿੱਚ ਕੋਈ ਵੀ ਧਾਰਮਿਕ ਕੋਈ ਵੀ ਫੰਕਸ਼ਨ ਮਨਾਇਆ ਜਾਂਦਾ ਹੈ ਜਾਂ ਕੋਈ ਵੀ ਤਿਉਹਾਰ ਮਨਾਇਆ ਜਾਂਦੇ ਹੈ ਅਤੇ ਲੋਕ ਭੰਗੜੇ ਪਾ ਪਾ ਕੇ ਆਪਦੀਆਂ ਖੁਸ਼ੀਆਂ ਮਨਾਉਂਦੇ ਹਨ ਚਾਹੇ ਵੋਟਾਂ ਪਾਉਣੀਆਂ ਹੋਣ ਚਾਹੇ ਕੋਈ ਵੀ ਖੁਸ਼ੀ ਦਾ ਦਿਨ ਹੋਵੇ ਇਸ ਭੰਗੜੇ ਤੋਂ ਬਿਨਾਂ ਪੰਜਾਬ ਦਾ ਤਿਉਹਾਰ ਸਫਲ ਨਹੀਂ ਹੋ ਸਕਦਾ ਕਿਉਂਕਿ ਭੰਗੜਾ ਹੀ ਸਭ ਤੋਂ ਵਧੀਆ ਇੱਕ ਇਹੋ ਜਿਹੀ ਸ਼ਾਨ ਹੈ ਜਿਹੜਾ ਸਰੀਰ ਨੂੰ ਚੁਸਤ ਤੰਦਰੁਸਤ ਰੱਖਦਾ ਹੈ ਅਤੇ ਇਸ ਲਈ ਕੋਈ ਜਿੰਮ ਜਾਣ ਦੀ ਲੋੜ ਨਹੀਂ ਪੈਂਦੀ ਘਰ ਬੈਠੇ ਹੀ ਬੱਚੇ ਗਾਣੇ ਲਾ ਕੇ ਭੰਗੜਾ ਆਪਦਾ ਕਰਕੇ ਅਤੇ ਆਪਦੇ ਸਰੀਰ ਨੂੰ ਤੰਦਰੁਸਤ ਬਣਾ ਲੈਂਦੇ ਹਨ ਅਤੇ ਆਪਦੇ ਸੱਭਿਆਚਾਰ ਨੂੰ ਕਾਇਮ ਰੱਖ ਸਕਦੇ ਹਨ ਇਸ ਲਈ ਭੰਗੜਾ ਸਾਡੇ ਪੰਜਾਬ ਦੀ ਸ਼ਾਨ ਆਨ ਹੈ ਕਿਉਂਕਿ ਜੇ ਕਿਤੇ ਭੰਗੜਾ ਨਹੀਂ ਪਾਇਆ ਗਿਆ ਤਾਂ ਸਮਝਿਆ ਜਾਂਦਾ ਪੰਜਾਬੀਆਂ ਦਾ ਤਿਉਹਾਰ ਫਿੱਕਾ ਹੈ ਕਿਉਂਕਿ ਭੰਗੜਾ ਹੀ ਹੈ ਜੋ ਪੰਜਾਬ ਨੂੰ ਦਰਸਾਉਂਦਾ ਹੈ ਚਾਹੇ ਵਿਸਾਖੀ ਦਾ ਮੇਲਾ ਹੋਵੇ ਤਰ੍ਹਾਂ ਤਰ੍ਹਾਂ ਦੇ ਮੇਲਿਆਂ ਵਿੱਚ ਪੰਜਾਬੀਆਂ ਦੀ ਸ਼ਾਨ ਹੈ ਕਿਉਂਕਿ ਬਾਹਰਲੇ ਮੁ ਮੁਲਕਾਂ ਵਿੱਚ ਵੀ ਪੰਜਾਬੀ ਸ ਸੱਭਿਆਚਾਰ ਦੀ ਪਹਿਚਾਣ ਭੰਗੜੇ ਤੋਂ ਹੀ ਲਗਾਈ ਜਾਂਦੀ ਹੈ ਭੰਗੜਾ ਹੀ ਹੈ ਜੋ ਸਾਡੇ ਆ ਪੰਜਾਬ ਨੂੰ ਪੇਸ਼ ਕਰਦਾ ਹੈ